ਮੇਰੇ ਅਨੁਸਾਰ ਜੇ ਅਸੀਂ ਕਿਸੇ ਐਪ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਹੈਗੇ ਆ ਉਹਨਾਂ ਨੂੰ ਇੱਕ ਰੁਜ਼ਗਾਰ ਜੋ ਕਿ ਉਹਨਾਂ ਦੇ ਅਕੋਰਡਿੰਗ ਹੋਵੇ ਜਿਹੜਾ ਕਿ ਉਹਨਾਂ ਦੇ ਇੰਟਰਸਟ ਅਤੇ ਉਹਨਾਂ ਦੇ ਐਜੂਕੇਸ਼ਨ ਨੂੰ ਸਪੋਰਟ ਕਰੇ ਉਹ ਤਿਆਰ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੋ ਸਕਦਾ ਜਿਹਦੇ ਨਾਲ ਜਿਹੜੇ ਲੋੜਵੰਦ ਬੰਦੇ ਹੈਗੇ ਆ ਉਹ ਆਪਣੇ ਜਿਹੜੇ ਰੋਜ਼ਗਾਰ ਨੂੰ ਲੱਭ ਕੇ ਆਪਣਾ ਰੋਜ਼ਗਾਰ ਲੈ ਸਕਦੇ ਨੇ ਇਹ ਤੋਂ ਇਲਾਵਾ ਜਿਹੜੇ ਲੋੜਵੰਦ ਜਿਹਨਾਂ ਨੂੰ ਕਾਰੀਗਰ ਚਾਹੀਦੀ ਹੈ ਜਾਂ ਐਕਸਪਰਟ ਚਾਹੀਦੇ ਆ ਉਹ ਉਸ ਐਪਸ ਤੋਂ ਰਜਿਸਟਰੇਸ਼ਨ ਕਰਾ ਕੇ ਆਪਣੇ ਜਿਹੜੇ ਲੋੜਵੰਦ ਕਾਰੀਗਰ ਜਾਂ ਐਕਸਪਰਟਸ ਉਹਨਾਂ ਨੂੰ ਚਾਹੀਦੇ ਆ ਉਹ ਉੱਥੋਂ ਉਹਨਾਂ ਨੂੰ ਲੱਭ ਸਕਦੇ ਆ ਇਹ ਅਸੀਂ ਇੱਕ ਗੇਟਵੇਅਰ ਦਾ ਕੰਮ ਕਰ ਸਕਦੇ ਹਾਂ ਜਿਹਦੇ ਵਿੱਚ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਮਦਦ ਕਰ ਸਕਦੇ ਹਾਂ ਕਿ ਜਿਹੜੇ ਰੋਜ਼ਗਾਰ ਚਾਹੁੰਦੇ ਆ ਉਹ ਰੋਜ਼ਗਾਰ ਉਹਨਾਂ ਨੂੰ ਮਿਲਣ ਅਤੇ ਜਿਹੜੇ ਰੋਜ਼ਗਾਰ ਦੇਣਾ ਚਾਹੁੰਦੇ ਉਹ ਸਕਿਲਸ ਵਾਲੇ ਬੰਦਿਆਂ ਨੂੰ ਉਹਨਾਂ ਨੂੰ ਉਦਾਂ ਦੀ ਸਕਿਲਸ ਮਿਲ ਜਾਣ ਇਹਦੇ ਨਾਲ ਦੋਨਾਂ ਦਾ ਭਲਾ ਹੋਊਗਾ ਜੇ ਜਿਹਦੇ 'ਚ ਕਿ ਜਿਹਨਾਂ ਨੂੰ ਲੋ ਲੋੜਵੰਦ ਚਾਹੀਦੇ ਆ ਉਹਨਾਂ ਨੂੰ ਲੋੜਵੰਦ ਮਿਲ ਜਾਊਗੇ ਕਾਰੀਗਰ ਉਹਨਾਂ ਦੇ ਕੰਮ ਕਰਨ ਵਾਸਤੇ ਅਤੇ ਜਿਹਨਾਂ ਨੂੰ ਕੰਮਕਾਰ ਵਾਸਤੇ ਰੋਜ਼ਗਾਰ ਚਾਹੀਦਾ ਉਹਨਾਂ ਨੂੰ ਰੋਜ਼ਗਾਰ ਵੀ ਮਿਲ ਜਾਏਗਾ ਰੋਜ਼ ਆਪਣਾ ਘਰ ਘਰ ਬਾਰ ਚਲਾਉਣ ਵਾਸਤੇ ਜਾਂ ਆਪਣੇ ਸਕਿਲਸ ਨੂੰ ਹੋਰ ਇਨਹੈਂਸ ਕਰਨ ਵਾਸਤੇ ਵਰਕਿੰਗ ਐਕਸਪੀਰੀਅੰਸ ਵੀ ਮਿਲ ਸਕਦਾ ਉਹਨਾਂ ਨੂੰ ਨਾਲ ਨਾਲ ਐਕਸਪਰਟਸ ਕੰਪਨੀਸ ਦੇ ਨਾਲ